ਪੰਜਾਬੀ ਭਾਸ਼ਾ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਸਾਡੇ ਗੁਰੂਆਂ ਪੀਰਾਂ ਤੋਂ ਹੋਂਦ ਵਿੱਚ ਆਈ ਸਭ ਤੋਂ ਪਹਿਲਾਂ ਪੰਜਾਬੀ ਨੂੰ ਗੁਰਬਾਣੀ ਦੀਆਂ ਤੁਕਾਂ ਵਿੱਚੋਂ ਲਿਆ ਹੈ ਇਸ ਤੋਂ ਬਾਅਦ ਅਸੀਂ ਅੱਜ ਕੱਲ੍ਹ ਗੱਲ ਕਰਦੇ ਹਾਂ ਗੁਰਮੁਖੀ ਲਿਪੀ ਹੋਂਦ ਵਿੱਚ ਆਈ ਇਸ ਨੂੰ ਅਸੀਂ ਪੈਂਤੀ ਅੱਖਰੀ ਵੀ ਕਹਿੰਦੇ ਹਾਂ ਜੇਕਰ ਅੱਜ ਕੱਲ੍ਹ ਗੱਲ ਕਰੀਏ ਤਾਂ ਪੰਜਾਬੀ ਭਾਸ਼ਾ ਵਿੱਚ ਅਖ਼ਬਾਰ ਵੀ ਲਿਖੇ ਜਾਂਦੇ ਹਨ ਬਹੁਤ ਵੱਡੇ ਵੱਡੇ ਵਿਦਵਾਨ ਹੋਏ ਹਨ ਜਿਨ੍ਹਾਂ ਦੀਆਂ ਸਵੈ ਜੀਵਨੀ ਸਾਨੂੰ ਪੰਜਾਬੀ ਭਾਸ਼ਾ ਵਿੱਚ ਮਿਲਦੀਆਂ ਹਨ ਇਨ੍ਹਾਂ ਨੂੰ ਪੜ੍ਹ ਕੇ ਅਸੀਂ ਬਹੁਤ ਕੁਝ ਸਿੱਖਦੇ ਹਾਂ